ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦਵਿੰਦਰ ਦੀਦੀ ਬੋਲ ਰਹੇ ਹੋ ਮੈਂ ਨਾ ਤੁਹਾਡੀ ਸਟੁ ਤੁਹਾਡੇ ਨਾਲ ਕਲਾਸਮੇਟ ਸੀਗੀ ਜਿਹੜੀ ਜਸਕੀਰਤ ਉਹਨਾਂ ਦੀ ਸਿਸਟਰ ਬੋਲ ਰਹੀ ਹਾਂ ਮੈਂ ਅਤੇ ਮੈਂ ਨਾ ਸੰਗਰੂਰ ਤੋਂ ਹਾਂ ਅਤੇ ਮੈਂ ਨਾ ਚੰਡੀਗੜ੍ਹ 'ਚ ਨਵੀਂ ਆਈ ਹਾਂ ਫੋਰਟੀ ਟੂ ਕੋਲਜ 'ਚ ਅਡਮਿਸ਼ਨ ਲਿੱਤੀ ਹੈ ਅਤੇ ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਸੀਗਾ ਕਿ ਮੈਨੂੰ ਕੋਲਜ ਦੇ ਨੇੜੇ ਤੇੜੇ ਕਿਤੇ ਕੋਈ ਪੀ ਜੀ ਮਿਲ ਜੂਗਾ ਕੋਈ ਮਤਲਬ ਮੈਨੂੰ ਨੇੜੇ ਵਾਲਾ ਚਾਹੀਦਾ ਜਿਹੜਾ ਮੈਨੂੰ ਕੋਲਜ 'ਚ ਆਉਣ ਜਾਣ 'ਚ ਵੀ ਕੋਈ ਦਿੱਕਤ ਨਾ ਹੋਵੇ ਅਤੇ ਮਾਰਕੀਟ ਵੀ ਉਹਦੇ ਕੋਲ ਹੀ ਹੋਵੇ ਹਾਂਜੀ ਉੱਥੇ ਮੈਂ ਅਡਮਿਸ਼ਨ ਲਿ ਲੈਣੀ ਹੈ ਅਤੇ ਮੈਂ ਇੱਥੇ ਨਵੀਂ ਵੀ ਹਾਂ ਅਤੇ ਅਗਰ ਮੇਰੇ ਘਰ ਤੋਂ ਮੈਨੂੰ ਕੋਈ ਮਿਲਣ ਆਉਂਦਾ ਹੈ ਤੇ ਉੱਥੇ ਪੀ ਜੀ 'ਚ ਕੋਈ ਬੰਦਿਸ਼ ਵੀ ਨਾ ਹੋਵੇ ਠੀਕ ਹੈ ਜੀ ਅਤੇ ਖਾਣੇ ਪੀਣੇ ਦਾ ਕਿੱਦਾਂ ਹੈ ਉੱਥੇ ਮਤਲਬ ਕੋਈ ਕਿੱਦਾਂ ਪੈਸੇ ਵਗੈਰਾ ਕਿੰਨੇ ਰੈਂਟ ਹਾਂਜੀ ਠੀਕ ਹੈ ਜੀ ਇੰਨਾ ਤਾਂ ਮੈਂ ਅਫੋਰਡ ਕਰ ਸਕਦੀ ਹਾਂ ਹਾਂਜੀ ਠੀਕ ਹੈ ਤੁਸੀਂ ਮੈਨੂੰ ਆਪਣਾ ਐਡਰੈਸ ਸੈਂਡ ਕਰਦੋ ਮੈਂ ਕੱਲ੍ਹ ਅ ਤੁਹਾਡੇ ਕੋਲ ਆ ਕੇ ਨਾ ਪੂਰਾ ਮਤਲਬ ਦੇਖ ਲਵਾਂਗੇ ਠੀਕ ਹੈ ਦੀਦੀ ਥੈਂਕ ਯੂ